ਮੈਂ ਵਰਿੰਦਰ ਕੁਮਾਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਹਾਂ ਮੈਂ ਇੱਕ ਅਧਿਆਪਕ ਦੇ ਤੌਰ 'ਤੇ ਕੰਮ ਕਰਦਾ ਹਾਂ

ਦੱਸਣਾ ਚਾਹੁੰਦਾ ਹਾਂ ਕਿ ਡਾਂਸ ਲੋਕਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ ਡਾਂਸ ਕਰਦੇ ਸਮੇਂ ਲੋਕ ਖੁਸ਼ੀ ਮਹਿਸੂਸ ਕਰਦੇ ਹਨ ਡਾਂਸ ਇੱਕ ਸਾਡੀ ਰੋਜ਼ਾਨਾ ਕਸਰਤ ਦਾ ਇੱਕ ਭਾਗ ਹੈ ਜਿਵੇਂ ਅਸੀਂ ਰੋਜ਼ ਕਸਰਤ ਕਰਦੇ ਹਾਂ ਇਵੇਂ ਹੀ ਥੋੜ੍ਹਾ ਟਾਈਮ ਆਪਾਂ ਡਾਂਸ ਕਰੀਏ ਤਾਂ ਆਪਣੇ ਆਪਾਂ ਸਰੀਰ ਨੂੰ ਦਿਮਾਗੀ ਤੌਰ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰੱਖ ਸਕਦੇ ਹਾਂ ਡਾਂਸ ਕਰਨਾ ਵੀ ਇੱਕ ਕਸਰਤ ਦਾ ਭਾਗ ਹੈ ਡਾਂਸ ਕਰਕੇ ਲੋਕ ਖੁਸ਼ੀ ਮਹਿਸੂਸ ਕਰਦੇ ਹਨ ਆਨੰਦ ਮਾਣਦੇ ਹਨ ਆਪਸ ਵਿੱਚ ਮੇਲ ਮਿਲਾਪ ਨਾਲ ਰਹਿੰਦੇ ਹਨ ਡਾਂਸ ਅਤੇ ਉਹੀ ਅਸੀਂ ਇੱਕ ਦੂਸਰੇ ਦੇ ਨੇੜੇ ਆਉਂਦੇ ਹਾਂ ਸਮਾਜ ਵਿੱਚ ਘੁਲ ਮਿਲ ਕੇ ਰਹਿੰਦੇ ਹਾਂ ਸਾਨੂੰ ਹਮੇਸ਼ਾ ਰੋਜ਼ਾਨਾ ਲਾਈਫ ਵਿੱਚ ਥੋੜ੍ਹਾ ਸਮਾਂ ਡਾਂਸ ਲਈ ਕੱਢਣਾ ਚਾਹੀਦਾ ਹੈ ਅਤੇ ਹੋਰਨਾ ਲੋਕਾਂ ਨੂੰ ਵੀ ਡਾਂਸ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਡਾਂਸ ਤੋਂ ਕਰਕੇ ਸਾਨੂੰ ਖੁਸ਼ੀ ਦੇ ਨਾਲ ਨਾਲ ਆਪਣਾ ਸਰੀਰਕ ਅਤੇ ਮਾਨਸਿਕ ਤੌਰ 'ਤੇ ਆਪਣੇ ਸਰੀਰ ਨੂੰ ਠੀਕ ਰੱਖ ਸਕਦੇ ਹਾਂ ਡਾਂਸ ਕਰਨ ਇੱਕ ਕਲਾ ਹੈ ਇਹ ਸਾਨੂੰ ਸਾਡੇ ਜੀਵਨ ਵਿੱਚ ਰਹਿਣਾ ਖੁਸ਼ੀ ਪ੍ਰਾਪਤ ਕਰਨਾ ਦੇ ਅਨੁਭਵ ਬਾਰੇ ਪ੍ਰੇਰਿਤ ਕਰਦੀ ਹੈ ਇਸ ਕਰਕੇ ਸਾਨੂੰ ਸਭ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਰੋਜ਼ਾਨਾ ਆਪਣੀ ਲਾਈਫ ਪੰਦਰ੍ਹਾਂ ਮਿੰਟ ਤੋਂ ਅੱਧਾ ਘੰਟਾ ਡਾਂਸ ਕਰਕੇ ਖੁਸ਼ੀ ਦਾ ਅਨੁ ਅਨੁਭਵ ਮਹਿਸੂਸ ਕਰਨਾ ਚਾਹੀਦਾ ਹੈ